ਜੀ ਮੈਂ ਬਚਪਨ ਤੋਂ ਹੀ ਇਤਿਹਾਸ ਨੂੰ ਸਿੱਖਣ ਵਿੱਚ ਮੇਰੀ ਰੁਚੀ ਰਹੀ ਹੈ ਅਤੇ ਮੈਂ ਆਨੰਦ ਵੀ ਮਾਣਿਆ ਜੇਕਰ ਅਤੀ ਅਸੀਂ ਇੱਕ ਇਤਿਹਾਸਕ ਘਟਨਾ ਦੀ ਗੱਲ ਕਰਦੇ ਹਾਂ ਤਾਂ ਜਿਸ ਤਰਾਂ ਮੈਂ ਇੱਕ ਸਿੱਖ ਧਰਮ ਨੂੰ ਬਿਲੋਂਗ ਕਰਦੀ ਹਾਂ ਤਾਂ ਸਾਡੇ ਜਿਹੜੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਹੋਏ ਹਨ ਉਹਨਾਂ ਦੀ ਜਿਹੜੇ ਜੀਵਨ ਆ ਉਹਨਾਂ ਦੀ ਜਿਹੜੀ ਜੀਵਨ ਦੀ ਮਿਸਾਲ ਆ ਉਹ ਕਿਤੇ ਵੀ ਦੁਨੀਆ ਦੇ ਵਿੱਚ ਨਹੀਂ ਮਿਲਦੀ ਉਹ ਇਹ ਆ ਕਿ ਸਭ ਤੋਂ ਪਹਿਲਾਂ ਜਿਹੜੇ ਨੌਵੇਂ ਗੁਰੂ ਨੇ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਪਿਤਾ ਨੇ ਉਹਨਾਂ ਨੇ ਹਿੰਦੂ ਧਰਮ ਦੇ ਲਈ ਆਪਣਾ ਜਿਹੜਾ ਸੀਸ ਵਾਰਿਆ ਜਦੋਂ ਕਿ ਆਪ ਸਿੱਖ ਹੋਣ ਦੇ ਬਾਵਜੂਦ ਕਿਸੇ ਦੂਸਰੇ ਧਰਮ ਨੂੰ ਬਚਾਉਣਾ ਅਤੇ ਉਹਦੇ ਲਈ ਆਪਣੇ ਆਪ ਦੀ ਕੁਰਬਾਨੀ ਦੇ ਦੇਣੀ ਇਹ ਬਹੁਤ ਵੱਡੀ ਗੱਲ ਸੀ ਅਤੇ ਉਸ ਤੋਂ ਬਾਅਦ ਸਿਰਫ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਨੌ ਸਾਲ ਦੇ ਨੇ ਜਦੋਂ ਪਿਤਾ ਦਾ ਸੀਸ ਉਹਨਾਂ ਦੇ ਕੋਲ ਆਉਂਦਾ ਅਤੇ ਫਿਰ ਗੁਰੂ ਸਾਹਿਬ ਜਵਾਨ ਹੋਏ ਵਿਆਹ ਹੋਏ ਉਹਨਾਂ ਦੇ ਘਰ ਚਾਰ ਪੁੱਤਰ ਹੋਏ ਅਤੇ ਚਾਰਾਂ ਪੁੱਤਰਾਂ ਨੂੰ ਉਹਨਾਂ ਨੇ ਸਿੱਖ ਧਰਮ ਤੋਂ ਵਾਰ ਦਿੱਤਾ ਜਿਹੜੇ ਛੋਟੇ ਬੱਚੇ ਨੇ ਸੱਤ ਅਤੇ ਨੌ ਸਾਲ ਦੀ ਉਮਰ ਹੈ ਉਹਨਾਂ ਦੀ ਉਹ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਚਿਣ ਕੇ ਚਿਣੇ ਜਾਂਦੇ ਨੇ ਅਤੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਵੱਡੇ ਦੋ ਪੁੱਤਰ ਨੇ ਉਹ ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਲੱਖਾਂ ਦੀ ਫੌਜ ਨਾਲ ਲੜਦੇ ਹੋਏ ਸ਼ਹੀਦ ਹੋ ਜਾਂਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਵੀ ਹਮੇਸ਼ਾ ਹੀ ਉਹਨਾਂ ਨੇ ਉਹਨਾਂ ਨੂੰ ਕੋਈ ਜਮੀਨ ਦੇ ਲਈ ਜਾਂ ਕੋਈ ਜਾਇਦਾਦ ਦੇ ਲਈ ਉਹਨਾਂ ਦੇ ਲੜਾਈਆਂ ਨਹੀਂ ਸੀ ਉਹਨਾਂ ਦੀ ਲੜਾਈ ਸੀ ਕਿ ਅਧਰਮ ਦੇ ਵਿਰੁੱਧ ਅਧਰਮ ਦੇ ਵਿਰੁੱਧ ਉਹਨਾਂ ਨੇ ਆਪਣਾ ਸਾਰਾ ਜਿਹੜਾ ਜੀਵਨ ਸੀ ਉਹ ਲਾ ਦਿੱਤਾ